ਆਪਣੇ ਪਿੰਡ ਵਿੱਚ ਕਰਿਆਨੇ ਦੀਆਂ ਦੁਕਾਨਾਂ ਦਾ ਵਰਨਣ ਇਸ ਪ੍ਰਕਾਰ ਹੈ ਵੀ ਕਰਿਆਨੇ ਦੀ ਦੁਕਾਨ ਦੇ ਵਿੱਚ ਖਾਣ ਪੀਣ ਨਾਲ ਸੰਬੰਧਿਤ ਬਹੁਤ ਚੀਜ਼ਾਂ ਹੁੰਦੀਆਂ ਨੇ ਘਰ ਵਿਚ ਰੋਜ਼ਾਨਾ ਵਰਤੋਂ ਵਾਲੀਆਂ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਸ ਵਿੱਚ ਸਾਬਣ ਤੇਲ ਕੰਘਾ ਬੁਰਸ਼ ਹੋਰ ਬਹੁਤ ਚੀਜ਼ਾਂ ਆਲੂ ਪਿਆਜ ਦਾਲਾਂ ਸਬਜ਼ੀਆਂ ਬਿਸਕੁਟ ਨਮਕੀਨ ਕੋਲਡ ਡਰਿੰਕਸ ਹੋਰ ਬਹੁਤ ਚੀਜ਼ਾਂ ਕਰਿਆਨੇ ਦੀ ਦੁਕਾਨ ਵਿੱਚ ਉਪਲਬਧ ਹੁੰਦੀਆਂ ਨੇ ਜਿਹੜੀਆਂ ਆਪਣੇ ਰੋਜ਼ਾਨਾ ਵਰਤੋਂ ਵਾਲੀਆਂ ਹੁੰਦੀਆਂ ਨੇ ਅਤੇ ਚੀਜ਼ ਲੈਣ ਤੋਂ ਪਹਿਲਾਂ ਚੀ ਉਹਦੀ ਕੀਮਤ ਜ਼ਰੂਰੀ ਪਤਾ ਹੋਣੀ ਚਾਹੀਦੀ ਹੈ ਕੀਮਤ ਪਤਾ ਹੋਣ ਤੋਂ ਬਾਅਦ ਹੀ ਚੀਜ਼ ਖਰੀਦੀ ਜਾ ਸਕਦੀ ਹੈ ਜੇ ਅਸੀਂ ਬਿਨਾਂ ਚੀਜ਼ ਦਾ ਕੀਮਤ ਪੁੱਛੇ ਚੀਜ਼ ਲੈਂਦੇ ਹਾਂ ਤਾਂ ਉਹ ਸਾਡੇ ਲਈ ਸਹੀ ਨਹੀਂ ਬੈਠਦੀ